ਸਾਡੇ ਧਾਰਮਿਕ ਤਿਉਹਾਰ ਜਿਵੇਂ ਕਿ ਗੁਰੂਆਂ ਦੇ ਪ੍ਰਕਾਸ਼ ਪੁਰਬ ਹੁੰਦੇ ਹੈ ਜਾਂ ਵਿਸਾਖੀ ਹੁੰਦੀ ਹੈ ਜਾਂ ਹੋਲਾ ਹੁੰਦਾ ਹੈ ਇਹ ਦਿਨਾਂ ਵਿੱਚ ਖ਼ਾਸ ਤੌਰ 'ਤੇ ਗੁਰਦੁਆਰਾ ਸਾਹਿਬ ਮਿੱਠੀ ਖੀਰ ਬਣਾਈ ਜਾਂਦੀ ਹੈ ਕੜਾਹ ਪ੍ਰਸ਼ਾਦ ਬਣ ਬਣਾਇਆ ਜਾਂਦਾ ਹੈ ਅਤੇ ਸਪੈਸ਼ਲ ਖਾਣੇ ਤਾਂ ਖਾਸ ਖਾਣੇ ਸਾਡੇ ਇਹੀ ਹੈ ਅਤੇ ਮਹਾਰਾਜ ਸਾਹਿਬ ਦਸਾਂ ਗੁਰੂਆਂ ਨੇ ਕਿਰਤ ਕਰਕੇ ਆਪਣੇ ਦਸਾਂ ਨਹੁੰਆਂ ਦੀ ਕਮਾਈ ਵਿੱਚੋਂ ਜੋ ਤੁਸੀਂ ਕਮਾ ਕੇ ਖਾ ਸਕਦੇ ਸਾਦਾ ਖਾਣ ਵਾਸਤੇ ਗੁਰੂਆਂ ਨੇ ਪ੍ਰੇਰਿਤ ਕੀਤਾ ਹੈ ਜੁ ਜਿਵੇਂ ਕੀ ਗੁਰਬਾਣੀ ਦੇ ਵਿੱਚ ਦਰਜ਼ ਹੈ ਫਰੀਦਾ ਦੇਖ ਪਰਾਈ ਚੌਪੜੀ ਨਾ ਤਰਸਾਇ ਜੀਅ ਰੁੱਖੀ ਸੁੱਖੀ ਖਾ ਕੇ ਠੰਢਾ ਪਾਣੀ ਪੀ ਫਰੀਦਾ ਰੋਟੀ ਮੇਰੀ ਕਾਠ ਦੀ ਜੋ ਲਾਵੇ ਮੇਰੀ ਭੁੱਖ ਜਿਨ੍ਹਾਂ ਖਾਧੀਆਂ ਚੌਪੜੀਆਂ ਘਣੇ ਸਹਿਣਗੇ ਦੁੱਖ